ਹੈਲੋ ਹਾਂਜੀ ਸਰ ਤੁਸੀਂ ਹੈਲੋ ਫੂਡਸ ਤੋਂ ਬੋਲ ਰਹੇ ਹੋ ਸਰ ਤੁਹਾਡਾ ਜਿਹੜਾ ਹੈਗਾ ਸ਼ੇਕ ਮੈਨੂੰ ਬਹੁਤ ਜ਼ਿਆਦਾ ਪਸੰਦ ਹੈਗਾ ਅਤੇ ਉਹਦਾ ਫਲੇਵਰ ਬਹੁਤ ਅੱਛਾ ਹੈਗਾ ਪਰ ਥੋੜ੍ਹਾ ਜਿਹਾ ਮੈਨੂੰ ਉਹ ਥੋੜ੍ਹਾ ਜਿਹਾ ਹੋਰ ਜ਼ਿਆਦਾ ਵਧੀਆ ਮਤਲਬ ਕਿ ਉਹਦੇ ਵਿੱਚ ਫਰੂਟ ਵਗੈਰਾ ਥੋੜ੍ਹਾ ਜਿਹਾ ਜ਼ਿਆਦਾ ਚਾਹੀਦਾ ਹੈਗਾ ਅਤੇ ਉਹਦੇ ਵਿੱਚ ਆਈਸ ਅਤੇ ਉਹਦੇ ਵਿੱਚ ਜਿਹੜਾ ਹੈਗਾ ਗਾ ਸਵੀਟ ਉਹ ਜ਼ਿਆਦਾ ਵਧੀ ਹੋਣਾ ਚਾਹੀਦਾ ਹੈਗਾ ਅਤੇ ਉਹ ਮੈਨੂੰ ਹੋਰ ਵੀ ਜ਼ਿਆਦਾ ਵਧੀਆ ਚਾਹੀਦਾ ਹੈਗਾ ਪਹਿਲਾਂ ਨਾਲੋਂ ਵੈਸੇ ਤਾਂ ਤੁਹਾਡਾ ਬਹੁਤ ਜ਼ਿਆਦਾ ਫੇਮਸ ਹੈਗਾ ਉਹ ਅਤੇ ਉਹ ਬਹੁਤ ਜ਼ਿਆਦਾ ਅੱਛਾ ਹੈਗਾ ਬਟ ਮੈਨੂੰ ਉਸ ਤੋਂ ਵੀ ਜ਼ਿਆਦਾ ਮਤਲਬ ਥੋੜ੍ਹਾ ਜਿਹਾ ਥੋੜ੍ਹਾ ਜਿਹਾ ਸਪੈਸ਼ਲ ਚਾਹੀਦਾ ਹੈਗਾ ਉਹ ਅਤੇ ਇਸ ਲਈ ਤੁਸੀਂ ਮੈਨੂੰ ਉਹ ਆਪਣਾ ਕਿੰਨੇ ਟਾਈਮ ਤੱਕ ਤੁਸੀਂ ਮੈਨੂੰ ਭੇਜ ਸਕਦੇ ਹੋ ਹੈਗੇ ਹੋ ਅਤੇ ਉਹਦੇ ਲਈ ਕਿੰਨਾ ਟਾਈਮ ਚਾਹੀਦਾ ਹੈਗਾ ਅਤੇ ਆਰਡਰ ਕੰਪਲੀਟ ਹੋਣ 'ਚ ਤੁਹਾਨੂੰ ਕਿੰਨਾ ਕੁ ਥੋੜ੍ਹਾ ਟਾਈਮ ਲੱਗ ਜਾਵੇਗਾ ਪਲੀਜ਼ ਮੈਨੂੰ ਇਹ ਦੱਸਿਓ ਤੁਸੀਂ ਅਤੇ ਬਾਕੀ ਉਹਦੇ ਫਲੇਵਰ 'ਚ ਜਿੰਨੇ ਵੀ ਹੈਗੇ ਆ ਤੁਸੀਂ ਉਹ ਮੈਨੂੰ ਦੱਸ ਦਿਓ ਕਿ ਮੈਂਗੋ ਸ਼ੇਕ ਜਾਂ ਸਟਰੋਬਰੀ ਸ਼ੇਕ ਦੋਨਾਂ ਦੇ ਵਿੱਚੋਂ ਕਿਹੜਾ ਜ਼ਿਆਦਾ ਮਤਲਬ ਵਧੀਆ ਹੈਗਾ ਗਾ ਤੁਸੀਂ ਉਹ ਹੀ ਮੈਨੂੰ ਭੇਜਿਓ ਅਤੇ ਆਹ ਮੈਨੂੰ ਉਹਦੇ ਨਾਲੋਂ ਮਤਲਬ ਜਿੱਦਾਂ ਬੈਸਟ ਚਾਹੀਦਾ ਸਾਰਾ ਕੁਛ ਅਤੇ ਜਿਵੇਂ ਕਿ ਉਹਦੇ ਵਿੱਚ ਫਰੂਟਸ ਵਗੈਰਾ ਸਾਰਾ ਕੁਛ ਜ਼ਿਆਦਾ ਵਧੀਆ ਅਤੇ ਮਿਲਕ ਵਗੈਰਾ ਥੋੜ੍ਹਾ ਜਿਹਾ ਜ਼ਿਆਦਾ ਵੱਧ ਹੋਣਾ ਚਾਹੀਦਾ ਉਹਦੇ ਵਿੱਚ ਅਤੇ ਥੋੜ੍ਹਾ ਜਿਹਾ ਮਤਲਬ ਕਿ ਉਹਦਾ ਫਲੇਵਰ ਸ ਮਤਲਬ ਉਹ ਉਹ ਹੋਣਾ ਚਾਹੀਦਾ ਹੈਗਾ ਕਿ ਯੰਮੀ ਹੋਣਾ ਚਾਹੀਦਾ ਹੈਗਾ ਉਹ ਪੂਰਾ